ਪੇਂਡੂ ਭਾਈਚਾ ਪੇਂਡੂ ਭਾਈਚਾਰਿਆਂ ਵਿੱਚ ਖੇਤੀਬਾੜੀ ਉਦਯੋਗ ਵਿੱਚ ਸੁਧਾਰ ਲਿਆਉਣ ਲਈ ਲੋਕਾਂ ਨੂੰ ਰਲ ਮਿਲ ਕੇ ਆਪਣੇ ਖੇਤੀ ਪ੍ਰੋਡਕਟਾਂ ਪ੍ਰੋਡਕਟਾਂ ਲਈ ਵਧੀਆ ਡਾਕਟਰਾਂ ਦੀ ਸਲਾਹ ਲੈਣ ਚਾਹੀਦੀ ਹੈ ਅਤੇ ਡਾਕ ਸਰਕਾਰ ਨੂੰ ਵੀ ਇੰਨ੍ਹਾਂ ਖੇਤੀਬਾੜੀ ਖੇਤੀਬਾੜੀ ਬਾਰੇ ਪ੍ਰੋਪਰ ਸਮਾਨ ਦੇਣਾ ਚਾਹੀਦਾ ਜਿਵੇਂ ਕਿ ਬਿਜਲੀ ਬਿਜਲੀ ਪ੍ਰੋਪਰ ਹੋਵੇ ਅਤੇ ਵਧੀਆ ਵਧੀਆ ਵਧੀਆ ਵਧੀਆ ਵਧੀਆ ਬੀਜ਼ ਵਗੈਰਾ ਭੇਜਣੇ ਚਾਹੀਦੇ ਹਨ ਅਤੇ ਲੋਕ ਆਪਣੇ ਲੋਕ ਆਪਣੇ ਖੇਤਾਂ ਵਿੱਚ ਵਧੀਆ ਪਾਣੀ ਦਾ ਵਿਕਾਸ ਕਰ ਸਕਣ ਅਤੇ ਵਧੀਆ ਫਸਲਾਂ ਉਗਾ ਸਕਣ ਅਤੇ ਪੇਂਡੂ ਭਾਈਚਾਰਿਆਂ ਵਿੱਚ ਖੇਤੀਬਾੜੀ ਖੇਤੀਬਾੜੀ ਦਾ ਆਮ ਆਮ ਸਹਿਚਾਰ ਆਮ ਸਹਿਚਾਰ ਹੋਣਾ ਚਾਹੀਦਾ ਹੈ ਅਤੇ ਵਧੀਆ ਰਲ ਮਿਲ ਕੇ ਖੇਤੀ ਵਗੈਰਾ ਕਰਨੀ